ਕਿਸਾਨਾਂ ਨੂੰ ਖੁਦਕੁਸ਼ੀ ਤੋਂ ਬਚਣ ਲਈ ਸਰਕਾਰ ਨੂੰ ਵਿੱਤੀ ਸਹਾਇਤਾ ਦੇਣੀ ਚਾਹੀਦੀ ਆ ਅਤੇ ਕਿਸਾਨਾਂ ਨੂੰ ਖੇਤੀ ਦੇ ਨਾਲ ਨਾਲ ਹੋਰ ਧੰਦੇ ਵੀ ਕਰਨੇ ਚਾਹੀਦੇ ਹੈ ਜਿਵੇਂ ਕਿ ਮ ਮੱਛੀ ਪਾਲਣਾ ਅਤੇ ਪਸ਼ੂ ਪਾਲਣ ਅਤੇ ਸੂਰ ਪਾਲਣੇ ਅਤੇ ਹੋਰ ਧੰਦੇ ਬਹੁਤ ਆ ਮੱਖੀਆਂ ਪਾਲਣਾ ਸ਼ਹਿਦ ਦੀਆਂ ਅਤੇ ਸ ਸ ਕਿਸਾਨਾਂ ਨੂੰ ਜਿਹੜੀ ਪ ਇਸ ਕਰਕੇ ਮਾਰ ਪੈ ਜਾਂਦੀ ਆ ਕਿ ਸਮੇਂ ਸਿਰ ਜਿਹੜੇ ਫਸਲ ਪੱਕੀ 'ਤੇ ਮੀਹ ਪੈ ਜਾਂਦੇ ਹਨੇਰੀਆਂ ਚਲਦੀਆਂ ਉਸ ਕਰਕੇ ਕਿਸਾਨ ਦੀ ਫਸਲ ਮਰ ਜਾਂਦੀ ਆ ਅਤੇ ਮੰਡੀ ਵਿੱਚ ਕੋਈ ਮੁੱਲ ਨਹੀਂ ਮਿਲਦਾ ਠੀਕ ਆ ਅਤੇ ਕਿਸਾਨ ਬੀਜ਼ ਸਪਰੇਹਾਂ ਉਹ ਵੀ ਠੀਕ ਨਹੀਂ ਮਿਲਦੀਆਂ ਅਤੇ ਕਿਸਾਨ ਕਰਜ਼ੇ ਦੇ ਬੋਝ ਥੱਲੇ ਦ ਦੱਬ ਜਾਂਦਾ ਹੈ ਅਤੇ ਕਿਸਾ ਗੋਰਮ ਸਰਕਾਰ ਨੂੰ ਚਾਹੀਦਾ ਕਿ ਉਸਦੀ ਵਿੱਤੀ ਮਦਦ ਕਰੇ ਅਤੇ ਉਸ ਨੂੰ ਹੋਰ ਵਿੱਤੀ ਸਹਾਇਤਾ ਦੇਵੇ ਕਿਸੇ ਕੋਈ ਵੀ ਕੰਮ ਹੋਰ ਇਸ ਤੋਂ ਇਲਾਵਾ ਕਰਨ ਲਈ ਤਾਂ ਕਿ ਕਿਸਾਨ ਖੁਦਕੁਸ਼ੀ ਤੋਂ ਬਚਿਆ ਜਾ ਸਕੇ